ਹਾਂਜੀ ਸਾਡੇ ਕੋਲ ਭੋਜਨ ਸੰਬੰਧੀ ਬਹੁਤ ਹੀ ਪਰੰਪਰਾਵਾਂ ਹਨ ਜਿਵੇਂ ਕਿ ਜ਼ਿਆਦਾਤਰ ਪੰਜਾਬ 'ਚ ਜਿਕਣਾ ਮੀਂਹ ਦਾ ਮੌਸਮ ਹੁੰਦਾ ਹੈ ਜੀ ਗੁਲਗੁਲੇ ਕਚੌਰੀਆਂ ਬਣਦੀਆਂ ਅਤੇ ਲੋਕ ਮਾਲ ਪੁੜੇ ਖਾਣਾ ਜ਼ਿਆਦਾ ਪਸੰਦ ਕਰਦੇ ਨੇ ਜੀ ਧੰਨਵਾਦ ਜੀ